ਮੈਨੂੰ ਯਾਤਰਾ ਕਰਨਾ ਬਹੁਤ ਪਸੰਦ ਹੈ ਕਿਉਂਕਿ ਯਾਤਰਾ ਕਰਨਾ ਇੱਕ ਤਰ੍ਹਾਂ ਹੋਬੀ ਹੀ ਹੈ ਮੇਰੀ ਅਲੱਗ ਅਲੱਗ ਜਗ੍ਹਾ 'ਤੇ ਯਾਤਰਾ ਕਰਨਾ ਆਪਣੇ ਪਰਿਵਾਰ ਨਾਲ ਯਾਤਰਾ ਕਰਨਾ ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗਦਾ ਹੈ ਸਭ ਤੋਂ ਜ਼ਿਆਦਾ ਚੰਗੀ ਸਭ ਤੋਂ ਜ਼ਿਆਦਾ ਚੰਗਾ ਮੈਨੂੰ ਲੱਗਦਾ ਤੀਰਥ ਸਥਾਨਾਂ 'ਤੇ ਜਾਣਾ ਸਭ ਤੋਂ ਵਧੀਆ ਤੀਰਥ ਸਥਾਨ ਮੈਨੂੰ ਹਰਿਮੰਦਰ ਸਾਹਿਬ ਲੱਗਦਾ ਹੈ ਹਰਿਮੰਦਰ ਸਾਹਿਬ ਜਾ ਕੇ ਜੋ ਸ਼ਾਂਤੀ ਜੋ ਸਕੂਨ ਜੋ ਅਨੰਦ ਮਿਲਦਾ ਹੈ ਉਹ ਸ਼ਾਇਦ ਦੁਨੀਆਂ 'ਚ ਕਿਤੇ ਵੀ ਨਹੀਂ ਮਿਲਦਾ ਹਰਿਮੰਦਰ ਸਾਹਿਬ ਜਦੋਂ ਵੀ ਜਾਂਦੇ ਹਾਂ ਤਾਂ ਅਸੀਂ ਪੂਰਾ ਪਰਿਵਾਰ ਜਾਂਦੇ ਹਾਂ ਅਤੇ ਆਸ ਪਾਸ ਦੇ ਕੁਛ ਆਂਢ ਗੁਆਂਢ ਨੂੰ ਵੀ ਨਾਲ ਲੈ ਲੈਂਦੇ ਹਾਂ ਕਿ ਚਲੋ ਜੀ ਅਸੀਂ ਯਾਤਰਾ ਕਰਕੇ ਆਈਏ ਹਰਿਮੰਦਰ ਸਾਹਿਬ ਦੀ ਬਹੁਤ ਖੂਬੀਆਂ ਹਨ ਉੱਥੇ ਸਭ ਦੀਆਂ ਝੋਲੀਆਂ ਭਰੀਆਂ ਜਾਂਦੀਆ ਹਨ ਉੱਥੇ ਇੱਕ ਮਨ ਦੀ ਅਲੱਗ ਸ਼ਾਂਤੀ ਹੁੰਦੀ ਹੈ ਉੱਥੇ ਇੱਕ ਅਲੱਗ ਮਨ ਦਾ ਖੇੜਾ ਹੁੰਦਾ ਹੈ ਉੱਥੇ ਕਿਸੇ ਜਾ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਚਿੰਤਾ ਤੁਹਾਡੇ ਮਨ ਵਿੱਚ ਨਹੀਂ ਰਹਿੰਦੀ ਅਸੀਂ ਹਰ ਹਰ ਅੱਜ ਹਰ ਧਰਮ ਦਾ ਲੋਕ ਉੱਥੋਂ ਝੋਲੀਆਂ ਭਰਵਾ ਰਿਹਾ ਹੈ ਹਰ ਧਰਮ ਦਾ ਲੋਕ ਉੱਥੇ ਜਾ ਕੇ ਆਪਣੇ ਮਨ ਦੀ ਸ਼ਾਂਤੀ ਪ੍ਰਾਪਤ ਕਰਨਾ ਚਾਹੁੰਦਾ ਹੈ ਇਹ ਇੱਕ ਇਹੋ ਜਿਹਾ ਤੀਰਥ ਸਥੱਲ ਹੈ ਤੀਰਥ ਤੀਰਥ ਸਥਾਨ ਹੈ ਜਿੱਥੇ ਹਰ ਧਰਮ ਦੇ ਲੋਕਾਂ ਵਾਸਤੇ ਦਰਵਾਜ਼ੇ ਖੁੱਲ੍ਹੇ ਹਨ ਇਸ ਕਰਕੇ ਮੈਨੂੰ ਇਹ ਤੀਰਥ ਸਥਾਨ ਤੀਰਥ ਯਾਤਰਾ ਕਰਨ ਵਾਸਤੇ ਬਹੁਤ ਅੱਛਾ ਲੱਗਦਾ ਹੈ